ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਜਾਂ ਫਿਰ ਕੋਈ ਇੱਦਾਂ ਹੁੰਦਾ ਹੈ ਨਾ ਤਾਂ ਫਿਰ ਮੈਂ ਸਭ ਨੂੰ ਹੀ ਬੋਲਦੀ ਹਾਂ ਇਵਨ ਮੈਂ ਵੀ ਬਣਾ ਲੈਂਦੀ ਹਾਂ ਤਾਂ ਮੈਨੂੰ ਖਿਚੜੀ ਜੋ ਸਭ ਤੋਂ ਵਧੀਆ ਔਰ ਮੈਨੂੰ ਲੱਗਦਾ ਹੈ ਕਿ ਹਰ ਇੱਕ ਬਿਮਾਰ ਬੰਦੇ ਲਈ ਨਾ ਸਬ ਅੱਛਾ ਪਕਵਾਨ ਹੈ ਇਹ ਅਤੇ ਇਹਨੂੰ ਕੀ ਸਿਰਫ ਥੋੜ੍ਹੇ ਜਿਹੇ ਚਾਵਲ ਲੈ ਕੇ ਉਹਨੂੰ ਹਲਕੇ ਜਿਹੇ ਮਸਾਲਿਆਂ ਦੇ ਵਿੱਚ ਭੁੰਨ ਕੇ ਥੋੜ੍ਹੇ ਜਿਹੇ ਪਿਆਜ਼ ਵਗੈਰਾ ਪਾ ਕੇ ਉਹਨੂੰ ਬਣਾਇਆ ਜਾ ਸਕਦਾ ਕਿਉਂਕਿ ਇਹ ਜਿਹੜੀ ਸਭ ਤੋਂ ਵਧੀਆ ਡਾਈਟ ਹੁੰਦੀ ਹੈ ਬਿਮਾਰੀ ਬਿਮਾਰ ਲਈ ਬੰਦੇ ਲਈ ਅਤੇ ਦੂਜਾ ਇਹ ਹੁੰਦਾ ਹੈ ਕਿ ਜਦੋਂ ਬੰਦਾ ਬਿਮਾਰ ਹੁੰਦਾ ਹੈ ਤਾਂ ਉਹ ਨਹੀਂ ਖਾ ਪਾਉਂਦਾ ਚੰਗੀ ਤਰ੍ਹਾਂ ਹੈ ਨਾ ਅਤੇ ਹਲਕਾ ਖਾਣਾ ਹੁੰਦਾ ਹੈ ਇਹਨੂੰ ਖਾਣ ਤੋਂ ਬਾਅਦ ਬੰਦਾ ਆਪਣੀ ਦਵਾਈ ਵੀ ਕਰ ਸਕਦਾ ਔਰ ਵਧੀਆ ਤੰਦਰੁਸਤੀ ਵੀ ਮਿਲਦੀ ਉਹਦੇ ਨਾਲ ਅਤੇ ਇਹ ਸਭ ਤੋਂ ਅੱਛਾ ਪਕਵਾਨ ਮੰਨਿਆ ਜਾਂਦਾ ਹੈ ਬਿਮਾਰੀ 'ਚ